ਇਸ ਖੇਤਰ ਦੇ ਲੋਕ ਅਧਾ ਅਧਿਆਤਮਿਕ ਮਾਰਗਦਰਸ਼ਨ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿੱਥੋਂ ਕਿ ਸਾਨੂੰ ਹਰ ਇੱਕ ਪ੍ਰਸ਼ਨ ਦਾ ਜਵਾਬ ਮਿਲਦਾ ਹੈ ਜੇਕਰ ਪਹਿਲੀ ਤੁੱਕ ਦੇ ਵਿੱਚ ਪ੍ਰਸ਼ਨ ਹੈ ਤਾਂ ਅਗਲੀ ਤੁੱਕ ਵਿੱਚ ਸਾਨੂੰ ਉਸਦਾ ਜਵਾਬ ਮਿਲ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਪਿਰਿਚੁਅਲ ਗੋਡ ਹਨ ਸਪਿਰਿਚੁਅਲ ਗੋਡ ਉਹ ਸਾਨੂੰ ਕੌਂਸਲਿੰਗ ਕਰਦੇ ਨੇ ਕੌਂਸਲਿੰਗ ਕਿਸ ਤਰ੍ਹਾਂ ਕਰਦੇ ਨੇ ਕਿ ਜਿਸ ਤਰ੍ਹਾਂ ਸਾਨੂੰ ਹਰ ਇੱਕ ਮਾਰਗ ਦਰਸ਼ਨ ਸਿਖਾਉਂਦੇ ਜੇ ਅਸੀਂ ਕਿਤੇ ਪਰੇਸ਼ਾਨ ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਵੋ ਅਤੇ ਤੁਹਾਨੂੰ ਉਸਦਾ ਉਸ ਗੱਲ ਦਾ ਜਵਾਬ ਮਿਲ ਜਾਵੇਗਾ ਕਿ ਇਹ ਕੰਮ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਕਿਵੇਂ ਹੋਣਾ ਹੈ ਇਹ ਵੀ ਪਤਾ ਲੱਗ ਜਾਵੇਗਾ ਜਿੱਥੇ ਸਾਇੰਸ ਖਤਮ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਸ਼ਨ ਉੱਤਰ ਸ਼ੁਰੂ ਹੁੰਦੇ ਨੇ ਅੱਜ ਕੱਲ੍ਹ ਤਾਂ ਡੋਕਟਰ ਵੀ ਫੇਲ੍ਹ ਹੋ ਗਏ ਹਨ ਜਦੋਂ ਕਿ ਹਰਿਮੰਦਰ ਸਾਹਿਬ ਦੇ ਵਿੱਚ ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਪਾਠ ਸੁਣਦਿਆਂ ਸੁਣਦਿਆਂ ਡਾਕਟਰ ਕੈਂਸਰ ਦਾ ਰੋਗ ਠੀਕ ਹੋਇਆ ਅਤੇ ਉਸ ਤੋਂ ਬਾਅਦ ਅਨੇਕਾਂ ਕੌਤਕ ਰੋਜ਼ ਦੇ ਰੋਜ਼ ਹੋ ਰਹੇ ਹਨ ਕਿਸੇ ਦੀਆਂ ਅੱਖਾਂ ਆ ਰਹੀਆਂ ਹਨ ਕਿਸੇ ਨੂੰ ਜ਼ੁਬਾਨ ਮਿਲ ਰਹੀ ਹੈ ਰੌਸ਼ਨੀ ਮਿਲ ਰਹੀ ਹੈ ਸਾਡੇ ਸਿਰਫ ਸ਼੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸਾਨੂੰ ਇਹ ਸਭ ਕੁਛ ਮਿਲਦਾ ਹੈ ਇਹ ਸਾਡੇ ਰਾਜਨੀਤਿਕ ਸਮਾਜਿਕ ਪਰਿਵਾਰਕ ਸਾਇੰਸ ਦੇ ਨਾਲ ਜੋ ਵੀ ਸਾਡੇ ਮਨ ਦੇ ਵਿੱਚ ਪ੍ਰਸ਼ਨ ਹੁੰਦੇ ਹਨ ਸਾਨੂੰ ਇਹਨਾਂ ਦਾ ਜਵਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਦਾ ਹੈ ਇਹ ਸਾਡੇ ਮਾਰਗ ਦਰਸ਼ਕ ਹਨ ਜਿਸ ਤਰ੍ਹਾਂ ਕਿ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ ਇਸ ਤਰ੍ਹਾਂ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪਾਲ ਰਹੇ ਹਨ ਜਿਸ ਤਰ੍ਹਾਂ ਕਹਿੰਦੇ ਨੇ ਰੋਜ਼ੀ ਰੋਟੀ ਦੇਣ ਵਾਲੇ ਇੱਕ ਗ੍ਰੰਥ ਸਾਡੇ ਵਾਸਤੇ ਜੋ ਤਿਆਰ ਕੀਤਾ ਗਿਆ ਗੁਰੂ ਜੀ ਨੇ ਤਿਆਰ ਕੀਤਾ ਗੁਰੂ ਅਰਜਨ ਦੇਵ ਜੀ ਨੇ ਮਾਰਗ ਦਰਸ਼ਕ ਸਭਨਾ ਕਾ ਮਾਂ ਪਿਉ ਆਪ ਹੈ ਆਪੇ ਸਾਰ ਕਰੇ ਸਾਡੇ ਸਾਰ ਕੌਣ ਕਰ ਰਹੇ ਨੇ ਸਾਡੇ ਪ੍ਰਤੱਖ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਸਾਡੇ ਮਾਰਗ ਦਰਸ਼ਕ ਆ ਜੇਕਰ ਅਸੀਂ ਵਿਸ਼ਵਾਸ ਨਾਲ ਮੰਨਦੇ ਹਾਂ ਕਿ ਸਾਡਾ ਮਾਰਗ ਦਰਸ਼ਕ ਹਨ ਅਤੇ ਉਹ ਸਾਨੂੰ ਸੱਚਾ ਸੁੱਚਾ ਮਾਰਗ ਵੀ ਦਿਖਾਉਂਦੇ ਹਨ